ਪੰਜਾਬ ਵਿੱਚ ਬਹੁਤ ਸਾਰੇ ਲੋਕ ਨਸ਼ੇ ਕਰਦੇ ਹਨ ਉਹਨਾਂ ਨੂੰ ਰੋਕਣ ਲਈ ਕੋਈ ਕਾਨੂੰਨੀ ਸਹਾਇਤਾ ਨਹੀਂ ਦਿੱਤੀ ਜਾਂਦੀ ਅ ਜੇਕਰ ਅਸੀਂ ਕਿਸੇ ਨੂੰ ਮਤਲਬ ਕਿ ਪੁਲਿਸ ਵਿੱਚ ਕੈਦ ਵੀ ਕਰਵਾਉਂਦੇ ਹਾਂ ਜਿਹੜੇ ਨਸ਼ਾ ਵੇਚਦੇ ਹੈ ਤਾਂ ਉਹਨਾਂ ਨੂੰ ਉਹ ਪੈਸੇ ਦੇ ਕੇ ਛੱਡ ਦਿੰਦੇ ਹੈ ਸਰਕਾਰ ਨੂੰ ਵੀ ਅਜਿਹੇ ਕ ਤਕੜੇ ਕਾਨੂੰਨ ਬਣਾਉਣਾ ਚਾਦ ਚਾਹੀਦੇ ਹਨ ਕਿ ਜਿਹੜੇ ਲੋਕ ਨਸ਼ਾ ਵੇਚਦੇ ਐਂ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਅਤੇ ਜਿਹੜੇ ਜਿਸ ਤਰ੍ਹਾਂ ਕਿ ਹੁਣ ਸਿੱਧੂ ਮੂਸੇਵਾਲਾ ਕਾਂਡ ਹੋਇਆ ਸੀਗਾ ਹੁਣ ਤੱਕ ਉਸਨੂੰ ਉਹਦੀ ਉਹਦੇ ਨਿਆਂਏ ਵਾਸਤੇ ਕੋਈ ਵੀ ਫ਼ੈਸਲਾ ਨਹੀਂ ਹੋ ਸਕਿਆ